ਹੈਲੋ ਭੈਣ ਜੀ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਭੈਣ ਜੀ ਤੁਸੀਂ ਠੀਕ ਹੋ

ਹਾਂਜੀ ਵਧੀਆ ਠੀਕ ਨੇ ਜੀ ਆਪਣੇ ਬੱਚੇ ਦੱਸੋ ਕਿਦਾ ਠੀਕ ਨੇ ਜੀ ਵਧੀਆ ਅੱਛਾ ਬੱਚੇ ਬਾਹਰ ਚਲੇ ਗਏ ਜੀ ਹਾਂਜੀ ਅੱਛਾ ਵਧੀਆ ਹੁਣ ਸੈਟ ਨੇ ਜੀ ਹਾਂ ਵਧੀਆ ਜੀ ਵਧੀਆ ਬਾਹਰ ਹੀ ਜਾਣਾ ਚਾਹੀਦਾ ਹੁਣ ਜੇ ਤਾਂ ਹੁਣ ਪੜ੍ਹ ਲਿਖ ਕੇ ਜੇ ਨੌਕਰੀਆਂ ਦੇ ਕਾਬਿਲ ਨੇ ਉਹਨਾਂ ਨੂੰ ਛੇਤੀ ਜੁਆਇਨਿੰਗ ਲੈਟਰ ਨਹੀਂ ਮਿਲ ਰਹੀ ਜੀ ਧਰਨੇ ਲਾਈ ਧਰਨੇ ਲਾਈ ਜਾਂਦੇ ਨੇਗੇ ਉਹਨਾਂ ਦਾ ਕੋਈ ਹੱਲ ਨਹੀਂ ਹੁੰਦਾ ਸਰਕਾਰ ਬੇਰੁਜ਼ਗਾਰ ਵਧਾਈ ਜਾਂਦੀ ਹੈ ਬਸ ਪੜ੍ਹੇ ਲਿਖੇ ਬੱਚਿਆਂ ਦਾ ਸੱਚ ਪੜ੍ਹੇ ਲਿਖੇ ਬੱਚਿਆਂ ਦਾ ਇੱਥੇ ਪੰਜਾਬ ਦੇ ਵਿੱਚ ਫਿਊਚਰ ਹੀ ਨਹੀਂ ਹੈਗਾ ਜੀ ਹਮ ਕੋਂਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ ਜੀ ਜਿਹੜੇ ਐਲੀਜੀਬਲ ਹੁੰਦੇ ਨੇ ਜੀ ਉਹਨਾਂ ਨੂੰ ਜੁਆਇਨਿੰਗ ਲੈਟਰ ਨਹੀਂ ਦਿੰਦੇ ਜੀ ਛੇਤੀ ਭਰਤੀਆਂ ਪੂਰੀਆਂ ਨਹੀਂ ਕਰਦੇ ਵਿੱਚ ਹੀ ਲਮਕਾ ਕੇ ਰੱਖਦੇ ਆ ਬਸ ਆਪਦੀ ਪਾਰਟੀ ਪਲੀਟੀਕਲੀ ਬੱਸ ਘੋਟੀ ਜਾਂਦੇ ਰਹਿੰਦੇ ਨੇਗੇ ਇਹ ਚੀਜ਼ਾਂ ਨੇ ਬਸ ਜੀ ਬਸ ਵੋਟਾਂ ਪੱਕੀਆਂ ਕਰਦੇ ਨੇ ਇੱਥੇ ਬਸ ਬਸ ਵਧੀਆ ਜੀ ਅਸੀਂ ਵੀ ਬਸ ਬਾ ਬਾਹਰ ਭੇਜਣ ਦੀ ਤਿਆਰੀ ਕਰੀ ਜਾਂਦੇ ਬੱਚਿਆਂ ਦੀ ਇੱਥੇ ਕੁਛ ਨਹੀਂ ਬਣਦਾ ਜੀ ਬੱਚਿਆਂ ਦਾ ਹਾਂਜੀ ਹਾਂਜੀ ਜੀ ਹਾਂ ਓਹੀ ਤਾਂ ਹੈ ਬੱਚੇ ਵਧੀਆ ਪੜ੍ਹ ਲਿਖ ਗਏ ਸੀਗੇ ਹੁਣ ਆਈਲੈਟਸ ਕਰਵਾਇਆ ਉਹਨਾਂ ਦਾ ਹੁਣ ਆਈਲੈਟਸ ਦੇ ਵਿੱਚ ਵਧੀਆ ਬੈਂਡ ਆ ਗਏ ਜੀ ਬੱਚਿਆਂ ਦੇ ਅਤੇ ਹੁਣ ਬਸ ਇਹਨਾਂ ਦੇ ਵੀਜ਼ਾ ਵਗੈਰਾ ਲਵਾਉਣਾ ਗਾ ਬਾਹਰ ਬਾਹਰ ਦੀ ਤਿਆਰੀ ਕਰ ਰਹੇ ਅਸੀਂ ਵੀ ਹਾਂਜੀ ਹਾਂ ਬਾਹਰ ਆਪਣੇ ਬੱਚਿਆਂ ਨੂੰ ਮਿਲ ਗਿਆ ਸੀ ਕੰਮ ਮਿਲ ਗਿਆ ਸੀ ਟਾਈਮ 'ਤੇ ਅੱਛਾ ਜੀ ਮੌਸਮ 'ਤੇ ਵੀ ਡਿਪੈਂਡ ਹੁੰਦਾ ਨਾ ਉੱਧਰ ਸਰਦੀ ਵਿੱਚ ਠੰਡ ਜ਼ਿਆਦਾ ਪੈਂਦੀ ਹੈ ਮੌਸਮ ਖਰਾਬ ਹੁੰਦਾ ਉਹਦੇ ਕਰਕੇ ਪ੍ਰੋਬਲਮ ਹੋ ਜਾਂਦੀ ਹੋਰ ਜੀ ਭਾਅ ਜੀ ਕਿੱਦਾਂ ਠੀਕ ਨੇ ਸਭ ਹਾਂਜੀ ਹਾਂਜੀ ਚੱਲੀ ਜਾਂਦਾ ਵਧੀਆ ਠੀ ਠੀਕ ਸਤਿ ਸ਼੍ਰੀ ਅਕਾਲ ਜੀ